ਸਤਿ ਸ਼੍ਰੀ ਅਕਾਲ ਤੁਸੀਂ ਬੋਲਦੇ ਹੋ ਅਸੀਂ ਪੰਦਰ੍ਹਾਂ ਦਿਨ ਪਹਿਲਾਂ ਇੱਕ ਔਡਰ ਕੀਤਾ ਸੀ ਜਿਸ ਵਿੱਚ ਬਰਗਰ ਪੀਜ਼ਾ ਐਂਡ ਰੈਪ ਸੀ ਅਤੇ ਅਸੀਂ ਅਤੇ ਉਹ ਪੀਜ਼ਾ ਮੇਰੇ ਮਾਤਾ ਜੀ ਨੇ ਖਾਧਾ ਜੋ ਕਿ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਫਿਰ ਮੈਂ ਆਪਣੇ ਪਿਤਾ ਜੀ ਨੂੰ ਟੇਸਟ ਕਰਵਾਇਆ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਪੀਜ਼ਾ ਮੈਂ ਆਪਣੇ ਚਾਚਾ ਚਾਚੀ ਤਾਇਆ ਤਾਈ ਐਂਡ ਦਾਦੀ ਜੀ ਨੂੰ ਖਵਾਇਆ ਅਤੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗਿਆ ਪਰ ਮੇਰੇ ਬ੍ਰਦਰ ਨੇ ਪੀਜ਼ਾ ਖਾਧਾ ਜੋ ਉਸ ਵਿੱਚ ਟਿੱਕੀ ਸੀ ਉਹਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਅਸੀਂ ਅੱਜ ਮੇਰੇ ਮਾਮਾ ਜੀ ਆ ਰਹੇ ਹਨ ਅਸੀਂ ਚਾਹੁੰਦੇ ਹਾਂ ਕੀ ਉਹ ਔਡਰ ਦੁਬਾਰਾ ਔਡਰ ਕਰੀਏ ਜੋ ਕਿ ਮੇਰੇ ਮਾਮਾ ਜੀ ਨਵਾਂਸ਼ਹਿਰ ਦੀ ਤਰੀਫ ਕਰ ਸਕਣ ਕਿ ਇੱਥੋ ਦਾ ਭੋਜਨ ਬਹੁਤ ਵਧੀਆ ਹੈ ਕ੍ਰੀਏਟਿਵ ਫੂਡ ਤੋਂ ਸੋ ਥੈਂਕ ਯੂ ਮੇਰਾ ਔਡਰ ਦੁਬਾਰਾ ਕਰ ਦਿਓ ਮੈਂ ਸ ਤੁਸੀਂ ਮੈਨੂੰ ਦੱਸ ਦਿਓ ਕਿ ਮੈਂ ਆਪਣੀ ਪੇਮੈਂਟ ਔਨਲਾਈਨ ਕਰਾਂ ਜਾਂ ਡਿਲੀਵਰੀ ਬੋਆਏ ਨੂੰ ਦਵਾਂ ਧੰਨਵਾਦ